ਸਤਿ ਸ਼੍ਰੀ ਅਕਾਲ ਜੀ ਬਿੰਦਰ ਬੋਲਦਾ ਜੀ ਮੈਂ ਜੀ ਮਾਨਸਾ ਵਿੱਦਿਆ ਭਾਰਤੀ ਤੋਂ ਜੀ ਹਾਂਜੀ ਸਕੂਲ ਬਹੁਤ ਵਧੀਆ ਜੀ ਪੂਰੇ ਇੰਡੀਆ 'ਚ ਬਰਾਂਚਾਂ ਨੇ ਇਹਨਾਂ ਦੀਆਂ ਵਿੱਦਿਆ ਭਾਰਤੀ ਦੀਆਂ ਹਾਂਜੀ ਹਾਂ ਬਹੁਤ ਵਧੀਆ ਸਕੂਲ ਆ ਜੀ ਹਾਂਜੀ ਹਾਂ ਮੇਰੇ ਬੱਚੇ ਵੀ ਉੱਥੇ ਹੀ ਪੜ੍ਹਦੇ ਨੇ ਜੀ

ਮੀਡੀਅਮ ਇੰਗਲਿਸ਼ ਮੀਡੀਅਮ ਹੈ ਉੱਥੇ ਅੰਗਰੇਜ਼ੀ ਮੀਡੀਅਮ ਅੱਛਾ ਕਿਹੜੀ ਆਪਣੀ ਕਿਹੜੀ ਕਿਹੜੀ ਕਲਾਸ 'ਚ ਨੇ ਬੱਚੇ ਤੁਹਾਡੇ ਅੱਛਾ ਅੱਛਾ ਫਿਰ ਤਾਂ ਪ੍ਰੀ ਨਰਸਰੀ 'ਚ ਜਾਂ ਨਰਸਰੀ 'ਚ ਲਾਉਂਗੇ ਅੱਛਾ ਜੀ ਠੀਕ ਆ ਜੀ ਹਾਂ ਵੈਨਾਂ ਜਾਂਦੀਆਂ ਜੀ ਸਾਰੇ ਪਿੰਡਾਂ 'ਚ ਵੀ ਜਾਂਦੀਆਂ ਨੇ ਲੋਕਲ ਵੀ ਜਾਂਦੀਆਂ ਨੇ ਤੁਸੀਂ ਕਿੱਥੋਂ ਲਾਉਣੇ ਬੱਚੇ ਖਰਚਾ ਜੀ ਫੀਸ ਆਪਣੀ ਲੋਕਲ ਦੀ ਤਾਂ ਛੇ ਸੱਤ ਸੌ ਰੁਪਇਆ ਜੀ ਮਹੀਨਾ ਹਾਂ ਜਿਹੜੇ ਪਿੰਡ ਆ ਬਾਕੀ ਕਿਲੋਮੀਟਰ ਦੇ ਹਿਸਾਬ ਨਾਲ ਆ ਜੀ ਕਿਲੋਮੀਟ ਹੈਂਜੀ ਨਰਸਰੀ ਪ੍ਰਾਇਮਰੀ ਦੀ ਜੀ ਜੇ ਆਪਾਂ ਪ੍ਰੀ ਨਰਸਰੀ ਦੀ ਗੱਲ ਕਰੀਏ ਉਹ 'ਚ ਤਾਂ ਹਜ਼ਾਰ ਕੁ ਰੁਪਇਆ ਐਡਮਿਸ਼ਨ ਫੀਸ ਹੈ ਜੀ ਬਾਕੀ ਅੱਠ ਕੁ ਸੌ ਰੁਪਇਆ ਮਹੀਨਾ ਫੀਸ ਆ ਜੀ ਇੱਕ ਬੱਚੇ ਦੀ ਹਾਂ ਜਿਹੜੇ ਹੈਗੇ ਨੇ ਬੱਚੇ ਥੋੜ੍ਹੇ ਜਿਹੇ ਵੱਡੇ ਜਿਵੇਂ ਥਰਡ 'ਚ ਆ ਜਾਂ ਫੋਰਥ 'ਚ ਆ ਉਹਨਾਂ ਬੱਚਿਆਂ ਦੀ ਅੱਠ ਕੁ ਹਜ਼ਾਰ ਰੁਪਇਆ ਐਡਮਿਸ਼ਨ ਫੀਸ ਆ ਇੱਕ ਵਾਰੀ ਲੱਗੂ ਸਾਲ 'ਚ ਐਡਮਿਸ਼ਨ ਫੀਸ ਹਾਂ ਮੁੜ ਕੇ ਨਹੀਂ ਲੱਗਦੀ ਹੈਂਜੀ ਹਾਂ ਗੇਮਾਂ ਬਹੁਤ ਵਧੀਆ ਜੀ ਗੇਮਾਂ ਇਹਦੇ ਵਿੱਚ ਨੈਸ਼ਨਲ ਤੱਕ ਜਾਂਦੇ ਆ ਸਟੂਡੈਂਟ ਇਹਦੇ ਸਿੱਧੇ ਐਸ ਜੀ ਐਫ ਆਈ 'ਚ ਹਾਂ ਗੇਮਾਂ ਬਹੁਤ ਵਧੀਆ ਨੇ ਜਿਵੇਂ ਖੋ ਖੋ ਹੋ ਗਈ ਕਬੱਡੀ ਹੋ ਗਈ ਫੁਟਬਾਲ ਹੋ ਗਈ ਹਾਂਜੀ ਅਤੇ ਜੁੱਡੋ ਹੋ ਗਈ ਹਾਂ ਇਨਡੋਰ ਵੀ ਆ ਆਊਟਡੋਰ ਦੋਨੇ ਤਰ੍ਹਾਂ ਦੀਆਂ ਗੇਮਾਂ ਹੁੰਦੀਆਂ ਜੀ ਹਾਂ ਬੱਚੇ ਨੈਸ਼ਨਲ ਖੇਡ ਕੇ ਆਉਂਦੇ ਨੇ ਜੀ ਬਹੁਤ ਬੱਚਿਆਂ ਦੀ ਗਡੇ ਗ੍ਰੇਡੇਸ਼ਨ ਹੋਈ ਆ ਹਾਂਜੀ ਹਾਂ ਬਾਕੀ ਕਲਾਸਾਂ ਕਲੂਸਾਂ ਦੇ ਵਿੱਚ ਹੀ ਸਰਦੀ 'ਚ ਵੀ ਗ ਗਰਮ ਖਾਣਾ ਮਿਲਦਾ ਹਾਂਜੀ ਹਾਂ ਬਾਕੀ ਆਪਣੇ ਪਿੰਡ ਦੇ ਸਾਰੇ ਜਵਾਕ ਉੱਥੇ ਨੇ ਹੈਂਜੀ ਇਹ ਤਾਂ ਬਹੁਤ ਪੁਰਾਣਾ ਜੀ ਇਹਨੂੰ ਤਾਂ ਹੋ ਗਏ ਚਾਲੀ ਪੰਜਾਹ ਸਾਲ ਹੋ ਗਏ ਮਾਨਸਾ ਦੇ ਵਿੱਚ ਬਰਾਂਚ ਨੂੰ ਬਾਕੀ ਪੂਰੇ ਹਾਂ ਹਾਂ ਪੂਰੇ ਇੰਡੀਆ ਦੇ ਵਿੱਚ ਬਰਾਂਚਾਂ ਜੀ ਇਹਨਾਂ ਦੀਆਂ ਹਾਂਜੀ ਬਹੁਤ ਪੁਰਾਣੀਆਂ ਬਰਾਂਚਾਂ ਨੇ ਹਾਂਜੀ ਹਾਂ ਤੁਸੀਂ ਆ ਜਿਓ ਕੋਈ ਗੱਲ ਨਹੀਂ ਜਦੋਂ ਮਰਜ਼ੀ ਆਉ ਤੁਹਾਡੀ ਸਾਰੀ ਇੰਟਰੋਡਕਸ਼ਨ ਕਰਾਵਾਂਗੇ ਤੁਹਾਨੂੰ ਗਰਾਊਂਡ ਦਿਖਾਵਾਂਗੇ ਖੇਡਾਂ ਵਾਲੇ ਸਕੂਲ ਦਿਖਾ ਦਿਆਂਗੇ ਸਾਰਾ ਹਾਂ ਹਾਂ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ ਠੀਕ ਆ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ